ਹੈਲੋ ਸਤਿ ਸ਼੍ਰੀ ਅਕਾਲ ਭੂਮਿਕਾ ਕਿਵੇਂ ਹੋ ਹਾਂਜੀ ਅਸੀਂ ਵੀ ਠੀਕ ਹੋਵਾਂਗੇ ਹੋਰ ਘਰ ਪਰਿਵਾਰ ਕਿੱਦਾਂ ਤੁਹਾਡਾ ਉਹ ਅੱਛਾ ਜਿਹੜੀ ਦਲਜੀਤ ਦੀ ਆਈ ਹੈ ਨਵੀਂ ਹਾਂ ਜੀ ਜੀ ਤੁਸੀਂ ਸਹੀ ਕਹਿ ਰਹੇ ਹੋ ਕਿਵੇਂ ਕਿ ਦਿਲਜੀਤ ਹੋ ਗਿਆ ਉਹਨਾਂ ਨੇ ਵੀ ਆਪਣਾ ਪੰਜਾਬ ਤੋਂ ਨਾਮ ਕਮਾਇਆ ਅਤੇ ਹੁਣ ਉਹ ਬੋਲੀਵੁੱਡ 'ਚ ਬੋਲੀਵੁੱਡ ਵਿੱਚ ਡੈਬਿਊ ਕਰ ਰਹੇ ਹਨ ਅਤੇ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਅਤੇ ਦਿਲਜੀਤ ਨੇ ਹਰ ਪਾਸੇ ਆਪਣਾ ਨਾਂ ਛਾਇਆ ਹੋਇਆ ਹੂੰ ਹੂੰ ਜੀ ਜਿਵੇਂ ਕਿ ਹੋ ਗਿਆ ਧਰਮਿੰਦਰ ਹੋ ਗਏ ਅਤੇ ਅ ਅਕਸ਼ੈ ਕੁਮਾਰ ਹੋ ਗਏ ਉਹ ਵੀ ਡੈਬਿਊ ਕਰ ਰਹੇ ਹਨ ਬੋਲੀਵੁੱਡ ਫਿਲਮਾਂ ਵਿੱਚ ਹਾਂਜੀ ਕੋਈ ਨਾ ਅ ਅਸੀਂ ਚੱਲਦੇ ਹਾਂ ਤੁਸੀਂ ਮੈਨੂੰ ਟਾਈਮ ਅਤੇ ਜਗ੍ਹਾ ਦੱਸ ਦਿਓ ਅਸੀਂ ਚੱਲਾਂਗੇ ਕਿਸੇ ਦਿਨ ਠੀਕ ਹੈ ਜੀ ਓਕੇ